ਸਤਿ ਸ਼੍ਰੀ ਅਕਾਲ ਮੈਂ ਪੰਦਰ੍ਹਾਂ ਦਿਨ ਪਹਿਲਾਂ ਤੁਹਾਡੇ ਤੋਂ ਇੱਕ ਕੁੜਤੀ ਮੰਗਵਾਈ ਸੀ ਜਿਹੜੀ ਕਿ ਮੈਨੂੰ ਬਹੁਤ ਪਸੰਦ ਆਈ ਮੈਂ ਉਸ ਨੂੰ ਹਰ ਰੋਜ਼ ਪਾਉਂਦੀ ਹਾਂ ਜਦੋਂ ਤੁਹਾਡੀ ਕੁੜਤੀ ਮੇਰੇ ਕੋਲ ਪਹੁੰਚੀ ਤਾਂ ਉਸਦਾ ਰੰਗ ਮੈਨੂੰ ਬਹੁਤ ਸੋਹਣਾ ਲੱਗਾ ਜੋ ਮੈਂ ਰੰਗ ਮੰਗਵਾਇਆ ਸੀ ਉਹੀ ਰੰਗ ਨਿਕਲਿਆ ਉਸਦਾ ਕੱਪੜਾ ਬਹੁਤ ਮਖਮਲੀ ਸੀ ਪਾਇਆ ਹੋਇਆ ਇੰਝ ਜਾਪਦਾ ਸੀ ਜਿਵੇਂ ਕਿ ਉਹ ਬਹੁਤ ਮਹਿੰਗੀ ਹੋਵੇ ਉਸ ਦੀਆਂ ਸਿਊਣਾਂ ਬਹੁਤ ਵਧੀਆ ਧਾਗੇ ਨਾਲ਼ ਕੀਤੀਆਂ ਹੋਈਆਂ ਸਨ ਉਹ ਬਜ਼ਾਰ ਨਾਲ਼ੋਂ ਬਹੁਤ ਸਸਤੀ ਮਿਲ ਗਈ ਮੈਂ ਉਸ ਨੂੰ ਤਿੰਨ ਚਾਰ ਵਾਰ ਧੋ ਵੀ ਲਿਆ ਉਸ ਦੇ ਰੰਗ ਵਿੱਚ ਕੋਈ ਫਰਕ ਨਹੀਂ ਪਿਆ ਉਸ ਦਾ ਪ੍ਰਿੰਟ ਮੈਨੂੰ ਬਹੁਤ ਵਧੀਆ ਲੱਗਾ ਮੇਰੇ ਸਾਰੇ ਘਰਦਿਆਂ ਨੂੰ ਬਹੁਤ ਪਸੰਦ ਆਇਆ ਉਹ ਕਹਿੰਦੇ ਇਹ ਕੁੜਤੀ ਤੂੰ ਕਿੱਥੋਂ ਲਈ ਹੈ ਮੈਂ ਉਹਨਾਂ ਨੂੰ ਦੱਸਿਆ ਕਿ ਇਹ ਕੁੜਤੀ ਮੈਂ ਇੱਕ ਖਜ਼ਾਨੇ 'ਚੋਂ ਕੱਢੀ ਹੈ ਅਤੇ ਉਹ ਮੇਰੀ ਗੱਲ ਸੁਣ ਕੇ ਹੱਸ ਪਏ ਫਿਰ ਮੈਂ ਉਹਨਾਂ ਨੂੰ ਦੱਸਿਆ ਇਹ ਕੁੜਤੀ ਮੈਂ ਔਨਲਾਈਨ ਮੰਗਵਾਈ ਹੈ ਉਹ ਕਹਿੰਦੇ ਸਾਨੂੰ ਵੀ ਇੱਦਾਂ ਦੀ ਕੁੜਤੀ ਔਡਰ ਕਰਦੇ ਮੰਗਵਾ ਕੇ ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਇਹ ਕੁੜਤੀ ਸਿਰਫ ਤਿੰਨ ਸੌ ਰੁਪਏ ਦੀ ਹੈ ਉਨਾਂ ਦੀ ਅੱਖਾਂ ਵੀ ਚਮਕ ਦੇਖਣ ਵਾਲ਼ੀ ਸੀ ਇੰਨਾ ਸਸਤਾ ਵੀ ਕੁਝ ਮਿਲ ਸਕਦਾ ਏ ਮੈਂ ਅੱਗੇ ਤੋਂ ਤੁਹਾਡੇ ਤੋਂ ਔਡਰ ਕਰਦੀ ਰਹਾਂਗੀ ਇੰਨੀ ਵਧੀਆ ਕੁੜਤੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਸ ਨਾਲ਼ ਮੇਰੀ ਦਿਨ ਦੁੱਗਣੀ ਰਾਤ ਚੌਗੁਣੀ ਮੇਰੀ ਇੱਜਤ ਬਣ ਗਈ